ਸਾਡੇ ਖੇਤਰ ਵਿੱਚ ਅਲੱਗ ਅਲੱਗ ਧਰਮ ਹਨ ਜਿਵੇਂ ਸਿੱਖ ਧਰਮ ਇਸਾਈ ਧਰਮ ਮੁਸਲਿਮ ਧਰਮ ਅਤੇ ਹਿੰਦੂ ਧਰਮ ਸਾਰੇ ਹੀ ਆਪਣੇ ਆਪਣੇ ਧਰਮਾਂ ਧਰਮਾਂ ਦੀ ਪੂਜਾ ਆਪਣੇ ਹੀ ਗੁਰੂਆਂ ਪੀਰਾਂ ਰਾਹੀਂ ਦੱਸੇ ਤਰੀਕੇ ਰਾਹੀਂ ਕਰਦੇ ਹਨ